ਹੈਲੋ ਹਾਂਜੀ ਜੋਤੀ ਰਾਣੀ ਜੀ ਕੀ ਹਾਲ ਚਾਲ ਹੈ ਬਹੁਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਅਸੀਂ ਪਹਿਲਾਂ ਤਾਂ ਸੋਚਿਆ ਸੀਗਾ ਕਿ ਕਿਤੇ ਹੋਰ ਲੈ ਜੀਏ ਬਟ ਜਵਾਕ ਜ਼ਿੱਦ ਕਰ ਰਹੇ ਨੇ ਕਿ ਅਸੀਂ ਮਾਨਸਾ ਘੁੰਮਣ ਜਾਣਾ ਅਤੇ ਸਾਨੂੰ ਇਹਦੇ ਬਾਰੇ ਕੁਛ ਪਤਾ ਨਹੀਂ ਤੁਸੀਂ ਤਾਂ ਪਹਿਲਾਂ ਤੋਂ ਰਹਿੰਦੇ ਹੋ ਤੁਸੀਂ ਦੱਸ ਦਿਉ ਮਾੜਾ ਜਿਹਾ ਇਹਦੇ ਬਾਰੇ ਹਾਂਜੀ ਹਾਂਜੀ ਹਾਂਜੀ ਕੋਈ ਘੁੰਮਣ ਯੋਗ ਹੋਰ ਥਾਂ ਹੋਵੇ ਹਾਂਜੀ ਹਾਂਜੀ ਚੀਜ਼ ਮਿਲਦੀ ਹਾਂਜੀ

ਵਧੀਆ ਲੱਗਦਾ ਕੋਈ ਗੱਲ ਨਹੀਂ ਕੋ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਤੁਸੀਂ ਤਾਂ ਰਹਿ ਰਹੇ ਹੋ ਤੁਹਾਨੂੰ ਬਹੁਤ ਜ਼ਿਆਦਾ ਪਤਾ ਹੋਊਗਾ ਸਾਡੇ ਬਾ ਸਾਡੇ ਨਾਲੋਂ ਜ਼ਿਆਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵਧੀਆ ਤੁ ਅਸੀਂ ਜ਼ਰੂਰ ਆਵਾਂਗੇ ਤੁਸੀਂ ਸਾਨੂੰ ਗਾਈਡ ਕਰੀ ਚੱਲਿਓ ਕੀ ਕੀ ਜਗ੍ਹਾ ਘੁੰਮਣ ਲਈ ਵਧੀਆ ਕਿਵੇਂ ਕਿੱਥੇ ਜਾਣਾ ਕਿਵੇਂ ਨਹੀਂ ਹਾਂਜੀ ਹਾਂਜੀ ਹਾਂਜੀ ਨਾਲੇ ਤੁਸੀਂ ਬੱਚਿਆਂ ਨੂੰ ਮਾਨਸਾ ਦੇ ਪਿੰਡ ਘੁੰਮਾਉਣ ਲਈ ਪ੍ਰੇਰਿਤ ਕਰਿਓ ਕਿਉਂਕਿ ਬੱਚੇ ਅੱਜ ਕੱਲ ਸ਼ਹਿਰ 'ਚ ਜ਼ਿਆਦਾ ਰਹਿ ਰਹੇ ਉਹਨਾਂ ਨੂੰ ਪਿੰਡਾਂ ਬਾਰੇ ਨਹੀਂ ਪਤਾ ਹੁੰਦਾ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਸੁਣ ਕੇ ਬਹੁਤ ਵਧੀਆ ਲੱਗਿਆ ਅਤੇ ਅਸੀਂ ਜ਼ਰੂਰ ਹੋਵਾਂਗੇ ਠੀਕ ਠੀਕ ਹੈ ਥੈਂਕ ਯੂ